ਮੇਰਾ ਨਾਮ ਗੀਤਾਂਜਲੀ ਹੈ ਮੈਂ ਤੁਹਾਡੇ ਨਾਲ਼ ਇੱਕ ਨੈਗੇਟਿਵ ਐਕਸਪੀਰੀਅੰਸ ਸ਼ੇਅਰ ਕਰਨ ਲੱਗੀ ਹਾਂ ਇੱਕ ਵਾਰੀ ਮੈਂ ਆਪਣੇ ਫਰੈਂਡਸ ਦੇ ਨਾਲ਼ ਟ੍ਰਿੱਪ 'ਤੇ ਜਾਣਾ ਸੀ ਜਿਸ ਲਈ ਮੈਂ ਮੀਸ਼ੋ ਐਪ ਤੋਂ ਇੱਕ ਕੁੜਤੀ ਮੰਗਵਾਈ ਸੀ ਜਿਸ ਤਰ੍ਹਾਂ ਦੀ ਮੈਂ ਕੁੜਤੀ ਮੰਗਵਾਈ ਸੀ ਜਿਸ ਤਰ੍ਹਾਂ ਦਾ ਮੇਰਾ ਸਾਈਸ ਸੀ ਕੁੜਤੀ ਦਾ ਔਰ ਜਿਸ ਤਰ੍ਹਾਂ ਦਾ ਕਲਰ ਮੰਗਵਾਇਆ ਸੀ ਉਹ ਉਸ ਦੇ ਨਾਲੋਂ ਬਿਲਕੁਲ ਵੱਖਰੀ ਮੈਨੂੰ ਮਿਲੀ ਸੀ ਇੱਕ ਤਾਂ ਉਹ ਕੁੜਤੀ ਮੈਨੂੰ ਟਾਈਮ 'ਤੇ ਉਪਲਬਧ ਨਹੀਂ ਹੋਈ ਜਿਸ ਕਾਰਨ ਮੈਨੂੰ ਬਹੁਤ ਗੁੱਸਾ ਆਇਆ ਅਤੇ ਜਦ ਉਹ ਮੈਨੂੰ ਉਪਲਬਧ ਹੋਈ ਤਾਂ ਉਸਦਾ ਸਾਈਜ਼ ਵੀ ਉਸ ਦੇ ਮੈਚ ਦਾ ਨਹੀਂ ਸੀ ਜੋ ਮੈਂ ਮੰਗਵਾਇਆ ਸੀ ਅਤੇ ਉਸ ਦਾ ਕਲਰ ਮੈਂ ਰੈੱਡ ਮੰਗਵਾਇਆ ਸੀ ਤਾਂ ਉਹਨਾਂ ਨੇ ਮੈਨੂੰ ਮਹਿਰੂਨ ਕਲਰ ਦੀ ਕੁੜਤੀ ਭੇਜ ਦਿੱਤੀ ਜਿਸ ਕਾਰਨ ਮੇਰੇ ਟ੍ਰਿੱਪ ਜਾਣ ਦੇ ਟਾਈਮ 'ਤੇ ਮੈਨੂੰ ਅਲੱਗ ਤੋਂ ਸ਼ੋਪਿੰਗ ਕਰਕੇ ਮੈਨੂੰ ਆਪਣੇ ਲਈ ਕੁੜਤੀ ਮੰਗਵਾਉਣਾ ਪਈ ਇਸ ਕਰਕੇ ਮੈਨੂੰ ਇਸ ਮੀਸ਼ੋ ਵਾਲੇ 'ਤੇ ਬਹੁਤ ਗੁੱਸਾ ਆਇਆ ਅਤੇ ਮੇਰਾ ਬਹੁਤ ਦਿਮਾਗ਼ ਖ਼ਰਾਬ ਹੋਇਆ ਅਤੇ ਨਾਲ਼ੇ ਮੇਰੇ ਪੈਸੇ ਵੀ ਵੇਸਟ ਗਏ ਕਿਰਪਾ ਕਰਕੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਦਾ ਕਸਟਮਰ ਤੁਹਾਨੂੰ ਪ੍ਰੋਡਕਟ ਕਹਿੰਦਾ ਹੈ ਕਿ ਸਾਨੂੰ ਇਸ ਤਰ੍ਹਾਂ ਦਾ ਪ੍ਰੋਡਕਟ ਚਾਹੀਦਾ ਹੈ ਕਿਰਪਾ ਕਰਕੇ ਤੁਸੀਂ ਉਸ ਤਰ੍ਹਾਂ ਦਾ ਪ੍ਰੋਡਕਟ ਆਪਣੇ ਕਸਟਮਰਾਂ ਤੱਕ ਭੇਜਿਆ ਕਰੋ ਤਾਂ ਕਿ ਉਹਨਾਂ ਦੇ ਨਾ ਪੈਸੇ ਬਰਬਾਦ ਹੋਣ ਅਤੇ ਨਾ ਉਹਨਾਂ ਦਾ ਟਾਈਮ ਬਰਬਾਦ ਹੋਵੇ ਅਤੇ ਉਹਨਾਂ ਨੂੰ ਵਧੀਆ ਤੋਂ ਵਧੀਆ ਉਹਨਾਂ ਦੇ ਪ੍ਰੋਡਕਟ ਟਾਈਮ ਸਿਰ ਮਿਲ ਸਕਣ